ਸਤਿ ਸ਼੍ਰੀ ਅਕਾਲ ਮੈਂ ਅੰਸ਼ ਮਹਾਜਨ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਅਤੇ ਮੈ ਅੱਜ ਤੁਹਾਨੂੰ ਇਹ ਦੱਸਣ ਜਾ ਰਿਹਾ ਹਾਂ ਕਿ ਔਨਲਾਈਨ ਮੈਂ ਚਿਤਰਕਾਰੀ ਦੇ ਕਿਹੜੇ ਕਿਹੜੇ ਤਰੀਕੇ ਸਿੱਖੇ ਅਤੇ ਮੈਂ ਕੀ ਕੀ ਉਹਨਾਂ ਚੋਂ ਸਿੱਖਿਆ ਪਹਿਲਾਂ ਤਰੀਕਾ ਹੈ ਗਰਿਡ ਮੈਥਡ ਇਹ ਮੈਥਡ ਬਹੁਤ ਹੀ ਕਾਰਗਰ ਮੈਥਡ ਹੈ ਇਹ ਮੈਥਡ ਮੇਰਾ ਫੇਵਰੇਟ ਹੈ ਕਿਉਂਕਿ ਇਸ ਵਿੱਚ ਮੇਰੀ ਗਲਤੀ ਹੋਣ ਦੀ ਬਿਲਕੁਲ ਵੀ ਚਾਂਸ ਨਹੀਂ ਹੁੰਦੇ ਇਹ ਮੈਥਡ ਵਿੱਚ ਸਾਨੂੰ ਇੱਕ ਡਰਾਇੰਗ ਸ਼ੀਟ ਲੈਣੀ ਹੁੰਦੀ ਹੈ ਉਸਨੂੰ ਬਰਾਬਰ ਸਾਈਜ਼ ਦੇ ਖਾਨਿਆਂ ਵਿੱਚ ਡਿਵਾਈਡ ਕਰਨਾ ਹੁੰਦਾ ਹੈ ਡਿਵਾਈਡ ਕਰਨ ਦੇ ਬਾਅਦ ਉਹਨਾਂ ਉੱਤੇ ਨੰਬਰਿੰਗ ਦੇਣੀ ਹੁੰਦੀ ਹੈ ਨੰਬਰਿੰਗ ਦੇਣ ਦੇ ਬਾਅਦ ਸੇਮ ਤਰੀਕਾ ਸਾਨੂੰ ਜਿਹੜੀ ਵੀ ਤਸਵੀਰ ਬਣਾਉਣੀ ਹੈ ਉਸ 'ਤੇ ਫੋ ਐਪ ਦੇ ਦੁਆਰਾ ਡੱਬੇ ਬਣਾਉਣੇ ਹੁੰਦੇ ਹੈ ਅਤੇ ਉਸ ਦੇ ਬਾਅਦ ਸਾਨੂੰ ਉਹ ਡੱਬੇ ਮੈਚ ਕਰਕੇ ਸ਼ੁਰੂਆਤ ਕਰਨੀ ਹੁੰਦੀ ਹੈ ਨੱਕ ਅੱਖ ਕੰਨ ਜਿੱਦਾਂ ਦੀ ਛੋਟੀ ਛੋਟੀ ਡਿਟੇਲਾਂ ਤੋਂ ਫਿਰ ਡਿਟੇਲਾਂ ਐਡ ਕਰਨ ਦੇ ਬਾਅਦ ਥੋੜ੍ਹੀ ਥੋੜ੍ਹੀ ਮੂੰਹ ਦੀ ਲਕੀਰਾਂ ਗਲੇ ਦੀ ਲਕੀਰਾਂ ਵਗੈਰਾ ਜਾਂ ਕੋਈ ਹੋਰ ਡਰਾਇੰਗ ਹੋਵੇ ਤਾਂ ਉਸ ਹਿਸਾਬ ਨਾਲ ਲਕੀਰਾਂ ਐਡ ਕਰਨੀ ਹੁੰਦੀ ਹੈ ਉਸਦੇ ਬਾਅਦ ਸਾਨੂੰ ਡੱਬਾ ਦੇਖ ਦੇਖ ਕੇ ਸ਼ੇਡਿੰਗ ਦੀ ਸ਼ੁਰੂਆਤ ਕਰਨੀ ਹੁੰਦੀ ਹੈ ਇਸ ਵਿੱਚ ਘੱਟੋ ਘੱਟ ਸ਼ੇਡਿੰਗ ਦੀਆਂ ਦੋ ਤੋਂ ਤਿੰਨ ਲੇਅਰਾਂ ਆਉਂਦੀਆਂ ਹਨ ਅਤੇ ਉਹਨਾਂ ਨੂੰ ਵੱਖਰੀ ਵੱਖਰੀ ਗਰੇਡ ਦੀ ਪੈਨਸਿਲਾਂ ਨਾਲ ਕੀਤਾ ਜਾਂਦਾ ਹੈ ਇਸ ਵਿੱਚ ਸਭ ਤੋਂ ਮਜੇਦਾਰ ਕੰਮ ਹੈ ਜਦੋਂ ਡਰਾਇੰਗ ਪੂਰੀ ਹੋ ਜਾਵੇ ਤਾਂ ਡੱਬੇ ਦੀ ਲਕੀ ਲਾਈਨਾਂ ਮਿਟਾਉਣ ਦਾ ਕਿਉਂਕਿ ਤੱਦ ਤੁਹਾਡੀ ਡਰਾਇੰਗ ਪੂਰੀ ਹੋ ਜਾਂਦੀ ਹੈ ਅਤੇ ਤੁਹਾਨੂੰ ਡੱਬੇ ਦੀ ਲਕੀਰਾਂ ਦੀ ਕੋਈ ਲੋੜ ਨਹੀਂ ਹੁੰਦੀ ਉਹਦੇ ਬਾਅਦ ਮੈਂ ਇੱਕ ਹੋਰ ਮੈਥਡ ਸਿੱਖੇ ਦਾ ਹੈ ਫਰੀ ਹੈਂਡ ਮੈਥਡ ਫਰੀ ਹੈਂਡ ਮੈਥਡ ਵਿੱਚ ਸਾਨੂੰ ਸਿੱਧੇ ਹੀ ਫੋ ਤਸਵੀਰ ਨੂੰ ਦੇਖ ਕੇ ਉਹਦੀ ਛੋਟੀ ਤੋਂ ਛੋਟੀ ਡਿਟੇਲਾਂ ਬਣਾਉਣੀਆਂ ਹੁੰਦੀਆਂ ਹਨ ਹੌਲੀ ਹੌਲੀ ਕਰਕੇ ਉਹ ਡਿਟੇਲਾਂ ਤੋਂ ਲਾਈਨਾ ਖਿੱਚ ਖਿੱਚ ਕੇ ਤਸਵੀਰ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈ ਇਸ ਵਿੱਚ ਸਾਨੂੰ ਸ਼ੇਡਿੰਗ ਨਾਲ ਦੇ ਨਾਲ ਕਰਨੀ ਹੁੰਦੀ ਹੈ ਨਹੀਂ ਅਤੇ ਤਸਵੀਰ ਖਰਾਬ ਵੀ ਹੋ ਸਕਦੀ ਹੈ ਅਤੇ ਚਿੱਤਰ ਤੁਹਾਡਾ ਬਿਲਕੁਲ ਵੀ ਸਹੀ ਨਹੀਂ ਪਾਵੇਗਾ ਅਤੇ ਇਹਦੇ ਬਾਅਦ ਓ ਮੈਂ ਹੋਰ ਵੀ ਤਰੀਕੇ ਸਿੱਖੇ ਸੀ ਜਿਵੇਂ ਕਿ ਹੈਚਿੰਗ ਸਟਿਲਪਿੰਗ ਇਹ ਤਰੀਕਿਆਂ ਨੂੰ ਤਾਂ ਸਿੰਪਲ ਪੈਨਸਲ ਨਾਲ ਹੀ ਕੀਤਾ ਜਾ ਸਕਦਾ ਹੈ ਵੈਸੇ ਮੈਂ ਇੱਕ ਗੱਲ ਦੱਸਣਾ ਭੁੱਲ ਹੀ ਗਿਆ ਕਿ ਗ੍ਰਿੱਡ ਮੈਥਡ ਵਿੱਚ ਬਲੈਂਡਿੰਗ ਅਤੇ ਸਿਬਲਿੰਗ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਏਅਰ ਬਰਡ ਕਾਟਨ ਬਰਡ ਨਾਲ ਹੀ ਕੀਤਾ ਜਾਵੇ ਤਾਂ ਵਧੀਆ ਹੈ ਅਤੇ ਜੇ ਬਲੈਂਡਿੰਗ ਸਟੰਪ ਹੋਵੇ ਤਾਂ ਹੋਰ ਵੀ ਵਧੀਆ ਹੈ ਹੈਂ ਮੈਂ ਕਿੰਨਾ ਕੁਝ ਦੱਸ ਹੀ ਦਿੱਤਾ ਹੈ ਤਾਂ ਤੁਹਾਨੂੰ ਵੀ ਪਤਾ ਲੱਗ ਗਿਆ ਹੋਵੇਗਾ ਡਰਾਇੰਗ ਦੇ ਬਾਰੇ ਕਿ ਮੈਂ ਔਨਲਾਈਨ ਕੀ ਕੀ ਸਿੱਖਿਆ ਹੈ ਵੈਸੇ ਤਾਂ ਮੈਂ ਔਨਲਾਈਨ ਯੂਟੀਊਬ 'ਤੇ ਵੀਡੀਓ ਦੇਖ ਕੇ ਹੀ ਇਹ ਸਭ ਕਰ ਲੈਂਦਾ ਹੈ ਪਰ ਕਦੇ ਕਦੇ ਮੈਨੂੰ ਇਸ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਮੈਥਡ ਸੋਖੇ ਹੀ ਇੰਨੇ ਹੈ ਕਿ ਹਰ ਕੋਈ ਬੰਦਾ ਬਿਨਾ ਇਹ ਸਭ ਦੇਖੇ ਦੂਖੇ ਵੀ ਬਣਾ ਸਕਦਾ ਹੈ ਕਿਉਂਕਿ ਇਹ ਸਭ ਚੀਜ਼ਾਂ ਬਣਾਉਣ ਨਾਲ ਬੰਦੇ ਦੇ ਦਿਮਾਗ ਦੀ ਡਿਵਲਪਮੈਂਟ ਬਹੁਤ ਸਹੀ ਹੁੰਦੀ ਹੈ ਚੱਲੋ ਮੇਰਾ ਤਾਂ ਹੋ ਗਿਆ